ਵੈਸੇ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗੇਮਾਂ ਖੇਡੀਆਂ ਨੇ ਜਿਵੇਂ ਗੱਲ ਕਰੀ ਜਾਈਏ ਜਦ ਕੀਪੈਡ ਵਾਲੇ ਫੋਨ ਹੁੰਦੇ ਸੀਗੇ ਤਾਂ ਉਸ ਸਮੇਂ ਵੀ ਮੈਨੂੰ ਗੇਮਾਂ ਖੇਡਣ ਦਾ ਬਹੁਤ ਸ਼ੌਂਕ ਹੁੰਦਾ ਸੀਗਾ ਅਤੇ ਮੈਂ ਬਹੁਤ ਸਾਰੀਆਂ ਗੇਮਾਂ ਖੇਡੀਆਂ ਜਿਵੇਂ ਕਿ ਗੱਲ ਗੱਲ ਕਰੀ ਜਾਈਏ ਬਚਪਨ ਦੀ ਬਚਪਨ ਵਿੱਚ ਸਪਾਈਡਰਮੈਨ ਬੈਟਮੈਨ ਮਾਰੀਓ ਸੁਪਰ ਮਾਰੀਓ ਕੌਂਟਰਾ ਇੱਦਾਂ ਦੀਆਂ ਗੇਮਾਂ ਬਹੁਤ ਖੇਡੀਆਂ ਨੇ ਜੇ ਗੱਲ ਕਰੀ ਜਾਵੇ ਹੁਣ ਦੀ ਹੁਣ ਜਿਹੜੀਆਂ ਜਿੱਦਾਂ ਫੋਨ 'ਚ ਗੇਮਾਂ ਚੱਲਦੀਆਂ ਨੇ ਉਹਨਾਂ ਵਿੱਚ ਮੈਂ ਨੀਡ ਫੋਰ ਸਪੀਡ ਵੀ ਬਹੁਤ ਖੇਡੀ ਹੈ ਅਤੇ ਪਬਜੀ ਬਹੁਤ ਖੇਡੀ ਹੈ ਅਤੇ ਆਪਣੀ ਬੀ ਜੀ ਐਮ ਆਈ ਬਹੁਤ ਖੇਡੀ ਹੈ ਅਤੇ ਗੱਲ ਕਰੀ ਜਾਈਏ ਜਿਹੜੀ ਮੈਨੂੰ ਮਨਪਸੰਦ ਗੇਮ ਸੀਗੀ ਹੁਣ ਦੇ ਸਮੇਂ ਵਿੱਚ ਉਹ ਸੀਗੀ ਪਬਜੀ ਜਿਹੜੀ ਕਿ ਮੈਂ ਬਹੁਤ ਜ਼ਿਆਦਾ ਖੇਡੀ ਹੈ ਅਤੇ ਉਸਦੀ ਇੱਕ ਨਾ ਨੁਕਸਾਨ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਇਹਦੇ ਵਿੱਚ ਨਾ ਮਤਲਬ ਐਦਾਂ ਹੋ ਜਾਂਦਾ ਬੰਦੇ ਨੂੰ ਬੀ ਜਦੋਂ ਖੇਡਣ ਲੱਗਦੇ ਹੈ ਨਾ ਬੰਦੇ ਨੂੰ ਐਨਾ ਚਸਕਾ ਪੈ ਜਾਂਦਾ ਅਤੇ ਉਹ ਗੇਮ ਤੋਂ ਦੂਰ ਜਾਂਦਾ ਹੀ ਨਹੀਂ ਅਤੇ ਹਰ ਸਮੇਂ ਉਹਨੂੰ ਚਾਹੀਦਾ ਵੀ ਗੇਮ ਖੇਡਦਾ ਰਵਾਂ ਖੇਡਦਾ ਰਵਾਂ ਐਦਾਂ ਦਾ ਹੁੰਦਾ ਹੈ ਇਹ ਪਬਜੀ ਗੇਮ ਵਿੱਚ ਇੱਦਾਂ ਹੈ ਜੇ ਜਿੱਦਾਂ ਤਿੰਨ ਚਾਰ ਮੋਡ ਨੇ ਇਹਦੇ ਵਿੱਚ ਜਿੱਦਾਂ ਇੱਕ ਹੈਗਾ ਮਤਲਬ ਕਿ ਮੈਪ ਵਾਲਾ ਮੋਡ ਹੈ ਜਿਹਦੇ ਵਿੱਚ ਜਿਹੜੀ ਨੋਰਮਲ ਗੇਮ ਹੁੰਦੀ ਹੈ ਇਹਦੇ ਵਿੱਚ ਹੁੰਦਾ ਇਹ ਸੌ ਬੰਦਿਆਂ ਦੀ ਗੇਮ ਹੁੰਦੀ ਹੈ ਅਤੇ ਅਸੀਂ ਚਾਰ ਟੀਮਮੇਟ ਹੁੰਦੇ ਹਾਂ ਅਤੇ ਬਲਿਊ ਜੋਨ ਹੁੰਦਾ ਅਤੇ ਉਸ ਤੋਂ ਬਾਅਦ ਉਹ ਜੋਨ ਹੌਲੀ ਹੌਲੀ ਘਟਦਾ ਰਹਿੰਦਾ ਹਰ ਮਤਲਬ ਕਿ ਦੋ ਦੋ ਮਿੰਟ ਬਾਅਦ ਹਾਂ ਦੋ ਮਿੰਟ ਬਾਅਦ ਉਹਦਾ ਜੋਨ ਛੋਟਾ ਹੁੰਦਾ ਰਹਿੰਦਾ ਅਤੇ ਜੋਨ ਦੇ ਵਿੱਚ ਵਿੱਚ ਅਤੇ ਫਾਈਟ ਹੁੰਦੀ ਹੈ ਅਤੇ ਸਾਨੂੰ ਸਾਡੇ ਕੋਲ ਗਨਸ ਹੁੰਦੀਆਂ ਨੇ ਜਿੱਦਾਂ ਏ ਆਰ ਹੋ ਗਈਆਂ ਸਨਾਈਪਰ ਹੋ ਗਈਆਂ ਗਰਨੇਡ ਹੋ ਗਏ ਸਮੋਕ ਹੋ ਗਈਆਂ ਇਹ ਸਾਰਾ ਬਹੁਤ ਚੀਜ਼ਾਂ ਹੁੰਦੀਆਂ ਨੇ ਨਾਈਫ ਹੋ ਗਏ ਅਤੇ ਇੱਦਾਂ ਦੀਆਂ ਚੀਜ਼ਾਂ ਬਹੁਤ ਹੁੰਦੀਆਂ ਨੇ ਜਿਨ੍ਹਾਂ ਨਾਲ ਅਸੀਂ ਇੱਕ ਦੂਜੇ ਬੰਦੇ ਨੂੰ ਮਾਰਨਾ ਹੁੰਦਾ ਅਤੇ ਆਪਣੀ ਟੀਮ ਨੂੰ ਲਾਸਟ ਤੱਕ ਬਚਾ ਕੇ ਰੱਖਣਾ ਹੁੰਦਾ ਅਤੇ ਜਿਹੜਾ ਲਾਸਟ ਜੋਨ ਵਿੱਚ ਬਚ ਜਾਂਦਾ ਜਦ ਜਿਹਦੇ ਬੰਦੇ ਦੀ ਟੀਮ ਬਚ ਜਾਂਦੀ ਹੈ ਜਾਂ ਜ਼ਰੂਰੀ ਨਹੀਂ ਵੀ ਟੀਮ ਹੀ ਬਚਣੀ ਹੋਵੇ ਇੱਕ ਬੰਦਾ ਵੀ ਬਚ ਜਾਵੇ ਨਾ ਟੀਮ ਦਾ ਤਾਂ ਵੀ ਉਹ ਵਿਨਰ ਹੁੰਦੀ ਹੈ ਟੀਮ ਸਾਰੀ ਅਤੇ ਇਹੀ ਆ ਮੇਰੀ ਸਭ ਤੋਂ ਵਧੀਆ ਗੇਮ ਅਤੇ ਮੈਨੂੰ ਬਹੁਤ ਵਧੀਆ ਲੱਗਦੀ ਹੈ ਇਹਦੇ ਵਿੱਚ ਹੋਰ ਇੱਕ ਟੀ ਡੀ ਐਮ ਮੋਡ ਹੁੰਦਾ ਹੈ ਇੱਕ ਆਪਣਾ ਨੋਰਮਲ ਹੁੰਦਾ ਜਿਹਦੇ ਵਿੱਚ ਸਿਰਫ ਦੋ ਮਿੰਟ ਦੀ ਗੇਮ ਹੁੰਦੀ ਹੈ ਅਤੇ ਉਹਨੂੰ ਅਸੀਂ ਕੁਇੱਕ ਮੋਡ ਕਹਿ ਦਿੰਦੇ